ਹਾਂਜੀ ਮੈਨੂੰ ਇੱਕ ਸਮਾਂ ਸੀ ਜਦੋਂ ਕਿ ਖਾਣਾ ਬਣਾਉਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਈ ਉਸ ਸਮੇਂ ਮੈਂ ਸਕੂਲ ਟਾਇਮ ਦੀ ਗੱਲ ਕਰ ਰਹੀ ਹਾਂ ਜਦੋਂ ਮੈਂ ਬਹੁਤ ਜ਼ਿਆਦਾ ਛੋਟੀ ਹੁੰਦੀ ਸੀ ਅਤੇ ਮੈਨੂੰ ਖਾਣਾ ਬਣਾਉਣ ਦੇ ਵਿੱਚ ਕੋਈ ਰੁਚੀ ਨਹੀਂ ਸੀ ਅਤੇ ਬਟ ਕੁਝ ਮਜਬੂਰੀ ਕਾਰਨ ਮੇਰੇ ਮੰਮਾ ਪਾਪਾ ਘਰੋਂ ਬਾਹਰ ਗਏ ਹੋਏ ਸਨ ਅਤੇ ਘਰ ਵਿੱਚ ਅਸੀਂ ਭੈਣ ਭਾਈ ਹੀ ਇਕੱਲੇ ਸੀ ਅਤੇ ਜਿਸ ਕਾਰਨ ਸਾਨੂੰ ਇਕੱਲਿਆਂ ਨੂੰ ਹੀ ਖਾਣਾ ਬਣਾਉਣਾ ਪਿਆ ਖਾਣੇ ਦੇ ਵਿੱਚ ਮੈਨੇ ਦਾਲ ਦਾਲ ਦੇ ਨਾਲ ਨਮਕੀਨ ਜੀਰਾ ਚਾਵਲ ਬਣਾਏ ਸਨ ਅਤੇ ਇਸ ਨਾਲ ਦਾਲ ਤਾਂ ਮੈਨੂੰ ਹੀ ਕੱਚੀ ਪੱਕੀ ਹੀ ਬਣਾਉਣੀ ਆਉਂਦੀ ਸੀ ਕਿਉਂਕਿ ਮੈਨੇ ਖਾਣਾ ਬਣਾਉਂਦੇ ਹੋਏ ਸਿਰਫ ਮੰਮੀ ਨੂੰ ਦੇਖਿਆ ਸੀ ਅਤੇ ਖਾਣਾ ਬਣਾਉਣਾ ਕਦੇ ਵੀ ਨਹੀਂ ਸੀ ਸਿੱਖਿਆ ਅਤੇ ਇਸ ਨਾਲ ਮੈਨੇ ਕੱਚਾ ਪੱਕਾ ਖਾਣਾ ਬਣਾਇਆ ਦਾਲ ਵਿੱਚ ਵੀ ਮੈਨੇ ਜ਼ਿਆਦਾ ਨਮਕ ਡਾਲ ਦਿੱਤਾ ਸੀ ਅਤੇ ਮੇਰੇ ਭਰਾ ਨੇ ਮੇਰੇ ਨਾਲ ਮਿਲ ਕੇ ਚਾਵਲ ਬਣਵਾਏ ਅਤੇ ਉਸਨੇ ਚਾਵਲ ਅਸੀਂ ਚੰਗੀ ਤਰ੍ਹਾਂ ਚੁਗੇ ਅਤੇ ਸਾਫ ਕਰਕੇ ਉਸ ਨੂੰ ਸਾਫ਼ ਪਾਣੀ ਦੇ ਵਿਚ ਧੋ ਕੇ ਉਹਦੇ ਨੂੰ ਉਹਨਾਂ ਨੂੰ ਜੀਰੇ ਦਾ ਤੜਕਾ ਲਾ ਕੇ ਬਣਾਇਆ ਅਤੇ ਜੋ ਕਿ ਅਸੀਂ ਦੋਨਾਂ ਨੇ ਰਲ ਮਿਲ ਕੇ ਖਾਇਆ ਅਤੇ ਉਸ ਦਿਨ ਤੋਂ ਬਾਅਦ ਅੱਜ ਮੈਂ ਹੁਣ ਚੰਗੀ ਤਰ੍ਹਾਂ ਖਾਣਾ ਬਣਾ ਸਕਦੀ ਹਾਂ ਅਤੇ ਹੁਣ ਮੈਂ ਕਿਸੇ ਵੀ ਟਾਈਪ ਦਾ ਖਾਣਾ ਬਣਾ ਸਕਦੀ ਹਾਂ ਅਤੇ ਉਸਨੂੰ ਚੰਗੀ ਤਰ੍ਹਾਂ ਸਵਾਦ ਬਣਾ ਸਕਦੀ ਹਾਂ ਧੰਨਵਾਦ